ਸਾਡੇ ਪਿੰਡ ਵਿੱਚ ਆਮ ਤੌਰ ਉੱਤੇ ਡਾਇਰੀ ਦਾ ਬਿਜਨਸ ਜਾਂ ਦੁੱਧ ਦਾ ਕੰਮ ਬਿਜਨਸ ਰੂਪ ਵਿੱਚ ਕੀਤਾ ਜਾਂਦਾ ਹੈ ਇੱਥੇ ਵਧੇਰੇ ਕਿਉਂ ਕਰਕੇ ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰ ਵੱਸਦੇ ਹਨ ਜਿਸ ਕਰਕੇ ਉਹਨਾਂ ਕੋਲ ਪਸ਼ੂ ਪਾਲਣ ਆਮ ਹੀ ਕੀਤਾ ਜਾਂਦਾ ਹੈ ਅਤੇ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੇ ਦੁੱਧ ਨੂੰ ਉਹ ਡਾਇਰੀ ਦੇ ਤੌਰ ਉੱਤੇ ਵੇਚਦੇ ਹਨ ਅਤੇ ਇਸ ਤੋਂ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਡਕਟ ਬਣਾ ਕੇ ਵੀ ਵੇਚੇ ਜਾਂਦੇ ਹਨ ਜਿਸ ਕਰਕੇ ਖੇਤੀਬਾੜੀ ਤੋਂ ਬਾਅਦ ਦੂਜੇ ਨੰਬਰ ਉੱਤੇ ਜੋ ਦੁੱਧ ਨਾਲ ਬਣੇ ਹੋਏ ਪਦਾਰਥ ਹਨ ਉਹ ਸਾਡੇ ਪਿੰਡ ਦਾ ਪ੍ਰਮੁੱਖ ਤੌਰ ਉੱਤੇ ਬਿਜਨਸ ਬਣਦੇ ਹਨ ਇਹਨਾਂ ਨੂੰ ਆਮ ਤੌਰ ਉੱਤੇ ਸ਼ਹਿਰਾਂ ਦੇ ਵਿੱਚ ਜਾ ਕੇ ਵੀ ਵੇਚਿਆ ਜਾਂਦਾ ਹੈ ਇਹਨਾਂ ਤੋਂ ਪ੍ਰਾਪਤ ਜਿਵੇਂ ਖੋਇਆ ਦਹੀਂ ਪਨੀਰ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਵੀ ਕੱਢ ਕੇ ਵੀ ਸ਼ਹਿਰਾਂ ਦੇ ਵਿੱਚ ਵੇਚਿਆ ਜਾਂਦਾ ਹੈ